ਹੈਲੋ ਗੁੱਡ ਮੌਰਨਿੰਗ ਮੈਮ ਸਤਿ ਸ਼੍ਰੀ ਅਕਾਲ ਮੈਮ

ਵਧੀਆ ਮੈਮ ਤੁਸੀਂ ਦੱਸੋ ਜੀ ਮੈਮ ਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਹੈਗਾ ਹੈ ਜੀ ਮੈਮ ਜ਼ਰੂਰ ਸੂਟ ਮੈਮ ਕਿੱਦਾਂ ਦਾ ਸਵਾਣਾ ਤੁਸੀਂ ਜੀ ਮੈਮ ਸਿਕਸ ਫਿਫਟੀ ਹੋਣਗੇ ਮੈਮ ਸਿੰਪਲ ਸੂਟ ਸਵਾਣਾ ਕੁਝ ਮਤਲਬ ਵਧੀਆ ਓਕੇਸ਼ਨਲੀ ਸੁਆਣਾ ਏ ਕਿੱਦਾਂ ਸੁਆਣਾ ਏ ਡਿਜ਼ਾਈਨਰ ਸੁਆਣਾ ਏ ਕਿੱਦਾਂ ਸੁਆਣਾ ਏ ਹਾਂਜੀ ਮੈਮ ਹਾਂਜੀ ਹਾਂਜੀ ਠੀਕ ਹੈ ਮੈਮ ਦੇਖੋ ਸਿੰਪਲ ਸੂਟ ਜਿਹੜਾ ਉਹਦੀ ਮੈਮ ਸਿਕਸ ਫਿਫਟੀ ਲੈਂਦੀ ਹੈ ਮੈਂ ਜਿਹੜੀ ਸਟੀਚਿੰਗ ਹੈ ਅਤੇ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਜਿੱਦਾਂ ਸਲੀਵਸ 'ਤੇ ਡਿਜ਼ਾਈਨ ਵਗੈਰਾ ਇਹ ਸਭ ਦੇ ਮੈਮ ਏਟ ਫ਼ਿਫਟੀ ਜਾਂ ਨਾਈਨ ਫ਼ਿਫਟੀ ਨੀਅਰ ਅਬਾਉਟ ਲੱਗਜੂਗੇ ਬਾਕੀ ਤੁਸੀਂ ਮੈਨੂੰ ਉਹ ਜਿਹੜਾ ਵੀ ਹੈ ਮਤਲਬ ਪੈਟਰਨ ਹੈ ਉਹ ਮੈਨੂੰ ਤੁਸੀਂ ਦਿਖਾ ਦਿਓ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਵੀਜ਼ਿਟ ਕਰੂਂਗੇ ਸ਼ੋਪ 'ਤੇ ਕਿ ਮੈਂ ਮੈਨੂੰ ਆਉਣਾ ਪੈਂਣਾ ਸ਼ੋਪ ਮੈਮ ਮੇਰੀ ਮੇਨ ਮੋਹਾਲੀ ਦੇ ਵਿੱਚ ਹੈ ਅਤੇ ਤੁਹਾਨੂੰ ਮੈਂ ਐਡਰੈਸ ਸੈਂਡ ਕਰਦਾਂਗੀ ਜੀ ਜੀ ਅਤੇ ਮੈਂ ਤੁਹਾਨੂੰ ਐਡਰੈਸ ਸੈਂਡ ਕਰਦਾਂਗੀ ਅਤੇ ਵੀਜ਼ਿਟ ਕਰਲਿਓ ਮੈਮ ਤੁਸੀਂ ਜੀ ਮੈਮ ਤੁਸੀਂ ਇੱਕ ਵਾਰ ਵੀਜ਼ਿਟ ਕਰਲਿਓ ਦੈਨ ਮੈਂ ਤੁਹਾਨੂੰ ਸਾਰਾ ਦੱਸ ਦਵਾਂਗੀ ਓਕੇ ਠੀਕ ਹੈ ਓਕੇ ਥੈਂਕ ਯੂ ਮੈਮ